ਤ ਤੁਸੀਂ ਗ ਗਾਰਨਰ ਸ਼ੋਪ ਤੋਂ ਬੋਲ ਰਹੇ ਹੋ ਜੀ ਅਸੀਂ ਤੁਹਾਡੇ ਤੋਂ ਨਾ ਮ ਕੱਪੜੇ ਮਤਲਬ ਲੈ ਕੇ ਗਏ ਸੀ ਗਰਮ ਕੱਪੜੇ ਜਿਵੇਂ ਸਵੈਟਰ ਹੋ ਗਿਆ ਜੈਕਟ ਅਤੇ ਉਹਦੇ 'ਚ ਨਾ ਇੱਕ ਮਤਲਬ ਸਾਈਜ਼ ਛੋਟਾ ਆ ਗਿਆ ਟਰਾਏ ਨਹੀਂ ਮੈਂ ਨਾ ਆਪਣੀ ਸਿਸਟਰ ਵਾਸਤੇ ਖਰੀਦਿਆ ਸੀ ਮੇਰੇ ਸਿਸਟਰ ਨਾ ਇੱਥੇ ਹੁਣ ਘਰ ਨਹੀਂ ਹੈਗੇ ਉਸ ਬਾਹਰ ਸਟਡੀ ਕਰ ਰਹੇ ਨੇ ਬਠਿੰਡਾ 'ਚ ਉੱਥੇ ਉਹਨਾਂ ਨੂੰ ਭੇਜਿਆ ਅਸੀਂ ਅਤੇ ਉੱਥੇ ਉਹਨੇ ਟਰਾਈ ਕੀਤਾ ਉਹਨਾਂ ਨੂੰ ਮਤਲਬ ਸਾਈਜ਼ ਸਹੀ ਨਹੀਂ ਆਇਆ ਹਾਂਜੀ ਅਤੇ ਮਤਲਬ ਸਾਨੂੰ ਉੱਥੋਂ ਜਾਣ 'ਚ ਟਾਈਮ ਲੱਗੇਗਾ ਮਤਲਬ ਦੋ ਦਿਨਾਂ 'ਚ ਅਸੀਂ ਅਕਸਚੇਂਜ ਕਰ ਸਕਦੇ ਹਾਂ

ਅਕਸਚੇਂਜ ਹੀ ਕਰ ਲੈਣਾ ਮਤਲਬ ਆ ਹਾਂਜੀ ਪਰ ਉਹ ਥੋੜ੍ਹੀ ਦਿੱਕਤ ਕਹਿ ਰਹੀ ਸੀ ਕਲਰ ਹੋਰ ਲੈਣਾ ਉਹਨਾਂ ਦੇਖ ਲਓ ਜੇ ਕੋਈ ਹੋ ਸਕਦਾ ਤਾਂ ਜ਼ਿਆਦਾ ਮਤਲਬ ਉਹ ਹੀ ਆ ਮਤਲਬ ਉਹ ਹੀ ਫਾਇਦੇ ਕੁਆਲਿਟੀ 'ਚ ਜ਼ਿਆਦਾ ਚਿਰ ਪੇ ਕਰਨਾ ਪੈਣਾ ਬਸ ਕਲਰ ਹੀ ਚੇਂਜ ਕਰ ਰਹੇ ਹਾਂ ਅਸੀਂ ਹਾਂਜੀ ਹਾਂਜੀ ਹਾਂਜੀ ਠੀਕ ਆ ਕੋਈ ਨਹੀਂ ਅਸੀਂ ਦੋ ਦਿਨ ਕੱਲ੍ਹ ਤੱਕ ਮੰਗਵਾ ਕੇ ਪਰਸੋਂ ਤੁਹਾਡੇ ਕੋਲ ਅਕਸਚੇਂਜ ਕਰ ਦਿਆਂਗੇ

ਹਾਂਜੀ ਅਸੀਂ ਨਵਾਂ ਵੀ ਕੁਛ ਖਰੀਦਣਾ ਹੀ ਹੈ ਤੁਹਾਡੇ ਤੋਂ ਹੀ ਲਵਾਂਗੇ ਅਤੇ ਡਿਸਕਾਉਂਟ ਦਿਓਂਗੇ ਹਾਂਜੀ ਮੇਰੇ ਦੋ ਤਿੰਨ ਫਰੈਂਡਸ ਨੇ ਅਤੇ ਇੱਕ ਮੈਂ ਅਸੀਂ ਸਾਰਿਆਂ ਨੇ ਹੀ ਖਰੀਦਣੇ ਨੇ ਵਿੰਟਰ ਵੀਅਰ ਅਤੇ ਸਾਨੂੰ ਵਧੀਆ ਜਿਹੀ ਡਿਸਕਾਊਂਟ ਦਿਓ ਜੇ

ਕੋਈ ਨਹੀਂ ਅਸੀਂ ਕੱਲ੍ਹ ਤੱਕ ਚੇਂਜ ਕਰਵਾ ਲਵਾਂਗੇ ਕੋਈ ਨਹੀਂ ਅੱਜ ਤਾਂ ਔਖਾ ਹੈ ਫਿਰ ਅੱਜ ਤਾਂ ਸਾਨੂੰ ਉੱਥੋਂ ਮੰਗਵਾਉਣੀ ਪੈਣੀ ਹੈ ਨਾ ਸਾਨੂੰ ਜਾਗਟ ਹਾਂਜੀ ਓਕੇ